ਮੈਂ ਪੰਜਾਬ ਦਾ ਵਾਸੀ ਹਾਂ ਅਤੇ ਮੈਨੂੰ ਜਾਨਵਰਾਂ ਨਾਲ ਸ਼ੁਰੂ ਤੋਂ ਹੀ ਬੜਾ ਬੜਾ ਮੋਹ ਅਤੇ ਪਿਆਰ ਰਿਹਾ ਹੈ ਮੈਂ ਆਪਣੇ ਫਾਰਮ ਹਾਊਸ ਵਿੱਚ ਇੱਕ ਬਹੁਤ ਹੀ ਊ ਸ਼ਾਨਦਾਰ ਅਤੇ ਵਧੀਆ ਤਰੀਕੇ ਨਾਲ ਦੇਸੀ ਮੁਰਗੀ ਪਾਲਣ ਲਈ ਪੋਲਟਰੀ ਫਾਰਮ ਖੋਲ੍ਹਿਆ ਹੈ ਜਿਸ ਵਿੱਚ ਮੈਂ ਚਾਰ ਮੁਰਗੀਆਂ ਤੋਂ ਸਟਾਰਟ ਕੀਤਾ ਸੀ ਚਾਰ ਮੁਰਗੇ ਅਤੇ ਚਾਰ ਮੁਰਗੀਆਂ ਜਿਸ ਨੂੰ ਵਧਦੇ ਵਧਦੇ ਹੁਣ ਮੇਰੇ ਕੋਲ ਤਿੰਨ ਸੌ ਦੇ ਲਾਗੇ ਮੁਰਗੀ ਅਤੇ ਮੁਰਗੇ ਹਨ ਜਿਸ ਵਿੱਚੋਂ ਡੇਢ ਸੌ ਤੋਂ ਦੋ ਸੌ ਅੰਡਾ ਪ੍ਰਤੀ ਦਿਨ ਮੈਨੂੰ ਪੈਦਾਵਾਰ ਹੁੰਦੀ ਹੈ ਅਤੇ ਉਸ ਨਾਲ ਮੈਨੂੰ ਕਮਾਈ ਵੀ ਕਾਫੀ ਜ਼ਿਆਦਾ ਹੁੰਦੀ ਹੈ ਇਸ ਵਿੱਚ ਜਦੋਂ ਮੈਂ ਚੂਚੇ ਛੋਟੇ ਚਿਕਸ ਲੈ ਕੇ ਆਇਆ ਸੀਗਾ ਉਸ ਵਿੱਚ ਨਿਯਮਿਤ ਸਮੇਂ 'ਤੇ ਉਹਨਾਂ ਦੀ ਸਿਹਤ ਜਾਂਚ ਕਰਵਾਈ ਸੀਗੀ ਅਤੇ ਉਹਨਾਂ ਨੂੰ ਵੈਕਸੀਨੇਸ਼ਨ ਟਾਈਮ ਟੂ ਟਾਈਮ ਮੈਂ ਕਰਵਾਉਂਦਾ ਰਿਹਾ ਅਤੇ ਹੁਣ ਅੱਗੇ ਵੀ ਕਰਵਾਉਂਦਾ ਹਾਂ ਜਿਸ ਨਾਲ ਮੁਰਗਿਆਂ ਦੀ ਕੋਈ ਵੀ ਬਿਮਾਰੀ ਜਿਸ ਬਿਮਾਰੀ ਨਾਲ ਮੁਰਗਿਆਂ ਨੂੰ ਛਿਕ ਆਉਂਦੀ ਸੀ ਜਾਂ ਮੁਰਗੇ ਬਿਮਾਰ ਹੁੰਦੇ ਸੀ ਜਿੱਦਾਂ ਕਿ ਰਾਣੀ ਖੇਤ ਦੀ ਬਿਮਾਰੀ ਜਾਂ ਹੋਰ ਵੀ ਕਈ ਬਿਮਾਰੀਆਂ ਹੁੰਦੀਆਂ ਹਨ ਵੈਸੇ ਤਾਂ ਪੋਲਟਰੀ ਫਾਰਮ ਵਿੱਚ ਕਈ ਤਰ੍ਹਾਂ ਦੀ ਨਸਲ ਆਉਂਦੀ ਹੈ ਮੁਰਗੀਆਂ ਦੀ ਪਰ ਮੈਂ ਜ਼ਿਆਦਾਤਰ ਸੋਨਾਲੀ ਅਤੇ ਡਬਲ ਐਫ ਜੀ ਮੁਰਗੇ ਰੱਖੇ ਹੋਏ ਹਨ ਹੁਣ ਮੈਂ ਸੋਚ ਰਿਹਾ ਹਾਂ ਕਿ ਕੋਕਰਿਲ ਦੀ ਵੀ ਵਰਾਇਟੀ ਰੱਖਾ